ਪਿੰਡਾਂ ਵਿੱਚ ਖੇਡ ਖੇਡਣ ਨਾਲ ਵਿਅਕਤੀ ਬਹੁਤ ਕੁਝ ਸਿੱਖਦਾ ਹੈ ਅਤੇ ਬਹੁਤ ਕੁਝ ਸਰੀਰਕ ਜੋ ਉਹਦੇ ਸਰੀਰ ਨੂੰ ਲੈ ਕੇ ਬਹੁਤ ਕੁਝ ਉਹਨੂੰ ਉਹਦੇ ਵਿੱਚ ਫਾਇਦਾ ਹੁੰਦਾ ਪਿੰਡਾਂ ਵਿੱਚ ਖੇਡਣ ਵਾਲੀਆਂ ਜ਼ਿਆਦਾ ਗੇਮਾਂ ਹਨ ਕਬੱਡੀ ਜੋ ਕਿ ਹਰੇਕ ਪਿੰਡ ਵਿੱਚ ਹਰੇਕ ਪੰਜਾਬੀ ਬੰਦਾ ਕਬੱਡੀ ਖੇਡਦਾ ਹੈ ਕਬੱਡੀ ਵਿੱਚ ਬੰਦੇ ਦਾ ਜੋਰ ਪਰਖਿਆ ਜਾਂਦਾ ਹੈ ਜਿਸ ਵਿੱਚ ਆਪਣਾ ਇੱਕ ਬੰਦਾ ਰੇਡਰ ਅਤੇ ਜਿਹੜਾ ਜਾਫੀ ਹੁੰਦਾ ਜਿਹਦੇ ਵਿੱਚ ਇੱਕ ਨੂੰ ਇੱਕ ਟੱਕਰਦਾ ਹੈ ਅਤੇ ਕਬੱਡੀ ਵੀ ਦੋ ਟਾਈਪ ਦੀ ਹੁੰਦੀ ਇੱਕ ਪਰੋ ਕਬੱਡੀ ਇੱਕ ਓਪਨ ਕਬੱਡੀ ਓਪਨ ਕਬੱਡੀ ਆਪਣੇ ਪੰਜਾਬੀ ਜ਼ਿਆਦਾ ਖੇਡਦੇ ਹਨ ਓਪਨ ਕਬੱਡੀ ਵਿੱਚ ਪਿੰਡਾਂ ਵਿੱਚ ਹਰੇਕ ਸਾਲ ਟੂਰਨਾਮੈਂਟ ਰੱਖੇ ਜਾਂਦੇ ਹਨ ਜਿਸ ਵਿੱਚ ਲੋਕਾਂ ਨੂੰ ਪੈਸੇ ਮਿਲਦੇ ਹਨ ਅਤੇ ਉਸ ਦੇ ਨਾਲ ਬੰਦਾ ਕਬੱਡੀ ਵਿੱਚ ਖੇਡਣ ਦੇ ਨਾਲ ਨਾਲ ਬੰਦਾ ਡਾਇਟ ਆਪਣੀ ਜਿਮ ਵਗੈਰਾ ਸਾਰਾ ਕੁਛ ਫੋਲੋ ਕਰਦਾ ਅਤੇ ਨਸ਼ਿਆਂ ਤੋਂ ਬਚਿਆ ਰਹਿੰਦਾ ਹੈ ਅਤੇ ਇਸ ਕਰਕੇ ਪੰਜਾਬ ਵਿੱਚ ਕਬੱਡੀ ਇੱਕ ਬਹੁਤ ਵੱਡੇ ਪੱਧਰ 'ਤੇ ਖੇਡੀ ਜਾਂਦੀ ਹੈ ਅਤੇ ਬਹੁਤ ਵੱਡੇ ਪੱਧਰ 'ਤੇ ਇਸਦੇ ਟੂਰਨਾਮੈਂਟ ਹੁੰਦੇ ਹਨ ਅਤੇ ਟੂਰਨਾਮੈਂਟ ਵਿੱਚ ਬਹੁਤ ਹੀ ਵਧੀਆ ਵਧੀਆ ਅਤੇ ਬਹੁਤ ਹੀ ਮਹਿੰਗੇ ਮਹਿੰਗੇ ਇਨਾਮ ਰੱਖੇ ਜਾਂਦੇ ਹਨ ਜਿਵੇਂ ਕਿ ਟਰੈਕਟਰ ਗੱਡੀਆਂ ਹੋਰ ਬਹੁਤ ਕੁਛ ਕਾਰਾਂ ਜੋ ਕਿ ਜੋ ਮਤਲਬ ਦਿੱਤਾ ਜਾਂਦਾ ਹੈ ਕਬੱਡੀ ਵਿੱਚ ਜੋ ਵੀ ਕਿ ਵਧੀਆ ਪਲੇਅਰ ਹੁੰਦਾ ਹੈ ਅਤੇ ਦੂਜੀ ਵਾਲੀਬੋਲ ਵਾਲੀਬੋਲ ਵੀ ਪਿੰਡਾਂ ਵਿੱਚ ਬਹੁਤ ਖੇਡਦੇ ਹਨ ਵਾਲੀਬੋਲ ਦਾ ਲਾਭ ਹੈ ਕਿ ਇੱਕ ਬੰਦਾ ਕੈੜਾ ਹੁੰਦਾ ਅਤੇ ਦੂਜਾ ਲੰਬਾ ਇਹ ਲੰਬੇ ਹੋਣ ਵਿੱਚ ਬਹੁਤ ਫਾਇਦਾ ਕਰਦੀ ਹੈ ਵਾਲੀਬੋਲ ਜਦੋਂ ਬੰਦਾ ਵਧੀਆ ਖੇਡਦਾ ਖਿੱਚਦਾ ਜੰਪ ਮਾਰਦਾ ਅਤੇ ਦੈਨ ਆਪਣੀ ਫਿਜੀਕਲ ਫਿੱਟਨੈੱਸ ਲਈ ਵਾਲੀਬੋਲ ਬੁਹਤ ਵਧੀਆ ਜੰਪ ਵਗੈਰਾ ਕਰਨਾ ਖਿੱਚਣਾ ਆਪਣੇ ਸਰੀਰ ਨੂੰ ਸਟਰੈਚ ਕਰਨਾ ਇਹਦੇ ਵਿੱਚ ਜੋ ਵਾਲੀਬੋਲ ਵਿੱਚ ਹੈ ਜੋ ਹੁੰਦਾ ਹੈ ਜਿਸ ਨਾਲ ਬੰਦਾ ਲੰਬਾ ਹੁੰਦਾ ਹੈ ਅਤੇ ਉਸਦੀ ਜੋ ਨਾੜਾਂ ਸਟਰੈਚ ਹੁੰਦੀਆਂ ਰਹਿੰਦੀਆਂ ਜਿਸ ਨਾਲ ਉਹਨੂੰ ਦਿੱਕਤ ਕੋਈ ਨਹੀਂ ਹੁੰਦੀ ਹੈਗੀ ਅਤੇ ਨਾਲੇ ਬਿਮਾਰੀ ਤੋਂ ਬਚਿਆ ਰਹਿੰਦਾ ਹੈ